ਸਤਿ ਸ਼੍ਰੀ ਅਕਾਲ ਜੀ ਮੈਂ ਨੀਤੀਕਾ ਘੁੱਦੇ ਤੋਂ ਬੋਲ ਰਹੀ ਹਾਂ ਜੀ ਤੁਸੀਂ ਗੁਰਮੀਤ ਟਰੈਵਲ ਏਜੰਸੀ ਤੋਂ ਬੋਲ ਰਹੇ ਹੋ ਜੀ ਹਾਂਜੀ ਅਸੀਂ ਤੁਹਾਡੀ ਕੈਬ ਜਾਂ ਕਾਰ ਬੁੱਕ ਕਰਵਾਉਣੀ ਸੀ ਨੋਵਾ ਗੱਡੀ ਅਸੀਂ ਸਾਰੀ ਫੈਮਿਲੀ ਨੇ ਅੰਮ੍ਰਿਤਸਰ ਜਾਣਾ ਜਿਸ ਸ ਜਿਸ ਵਿੱਚ ਅਸੀਂ ਛੇ ਜਣੇ ਹਾਂ ਜੀ ਹਾਂਜੀ ਉਹਦੇ ਅਸੀਂ ਤੁਹਾਡੇ ਮਤਲਬ ਰੈਂਟ ਬਾਰੇ ਪੁੱਛਣਾ ਸੀਗਾ ਵੀ ਤੁਹਾਡਾ ਜਿਹੜਾ ਚਾਰ ਦਿਨਾਂ ਦਾ ਖਰਚਾ ਗੱਡੀ ਦਾ ਉਹ ਕਿਵੇਂ ਲਉਂਗੇ ਤੁਸੀਂ ਕਿਲੋਮੀਟਰਾਂ ਦੇ ਹਿਸਾਬ ਨਾਲ ਲਉਂਗੇ ਤਾਂ ਸਾਨੂੰ ਉਹ ਵੀ ਦੱਸ ਦਿਉ ਵੀ ਵੀ ਚਾਰ ਦਿਨਾਂ ਦਾ ਸਾਰਾ ਉਕਣ ਪੁੱਕਾ ਕਰੋਗੇ ਤਾਂ ਸਾਨੂੰ ਉੱਦਾਂ ਵੀ ਤੁਸੀਂ ਦੱਸ ਦਿਉ ਵੀ ਤੁਹਾਡਾ ਕੀ ਰੈਂਟ ਹੈਗਾ ਅਤੇ ਇਹਦੇ ਵਿੱਚ ਅਸੀਂ ਤੁਹਾਡੇ ਤੋਂ ਪਹਿਲਾਂ ਗੱਲ ਇਹ ਪੁੱਛਣਾ ਸੀਗਾ ਵੀ ਜਿਹੜੇ ਚਾਰ ਦਿਨਾਂ ਦਾ ਡਰਾਈਵਰ ਦਾ ਜਿਹੜਾ ਖਰਚਾ ਹੈ ਉਹ ਕਿਵੇਂ ਹੋਊਗਾ ਤੁਸੀਂ ਵੀ ਸਾਡੇ ਤੋਂ ਲਊਗਾ ਡਰਾਈਵਰ ਦਾ ਚਾਹ ਪਾਣੀ ਰਹਿਣ ਦਾ ਖਰਚਾ ਕਿ ਵਿੱਚ ਹੀ ਸਾਡੇ ਜਿਹੜਾ ਕਿਰਾਏ ਦੇ ਇੰਕਲੂਡ ਹੋ ਜਾਊਗਾ ਵੀ ਵਿੱਚ ਹੀ ਸਾਰਾ ਕੁਛ ਹੋਜੂਗਾ ਅਤੇ ਨਾਲ ਦੀ ਨਾਲ ਸਾਨੂੰ ਇਹ ਦੱਸੋ ਵੀ ਜਿਹੜੇ ਉੱਥੇ ਟੋਲ ਪਲਾਜ਼ੇ ਪੈਂਦੇ ਆ ਅਤੇ ਪੈਟਰੋਲ ਦਾ ਖਰਚਾ ਉਹ ਵੀ ਤੁਸੀਂ ਆਪਦੇ ਜਿਹੜੇ ਉਹਦੇ ਰੈਂਟ ਦੇ ਵਿੱਚ ਲਉਗੇ ਕਿ ਉਹ ਸਾਡਾ ਹੋਵੇਗਾ ਅਤੇ ਜਿਹੜਾ ਸਾਨੂੰ ਡਰਾਈਵਰ ਉਹ ਵਧੀਆ ਚਾਹੀਦਾ ਹੈ ਨਾ ਨਸ਼ਾ ਪੱਤਾ ਨਾ ਕਰਦਾ ਹੋਵੇ ਕਿਉਂਕਿ ਅਸੀਂ ਫੈਮਲੀ ਮੈਂਬਰਾਂ ਨਾਲ ਜਾਣਾ ਅਤੇ ਅਸੀਂ ਪੰਜ ਤਰੀਕ ਪੰਜ ਜੂਨ ਨੂੰ ਜਾਣਾ ਅਤੇ ਤੁਸੀਂ ਸਾਨੂੰ ਆਪਦਾ ਜਿਹੜੀ ਹੈਗੀ ਹੈ ਕਿਰਾਏ ਦਾ ਸਾਰਾ ਪੇਮੈਂਟ ਦੱਸ ਦਿਉ ਅਤੇ ਫੇਰ ਅਸੀਂ ਤੁਹਾਨੂੰ ਸਾਈ ਦੇ ਤੌਰ 'ਤੇ ਅੱਧਾ ਜਿਹੜੀ ਪੇਮੈਂਟ ਆ ਹੁਣੀ ਗੂਗਲ ਪੇਅ ਤਾਂ ਕਰ ਦਵਾਂਗੇ ਸਾਨੂੰ ਉਹਦਾ ਸਕੈਨਰ ਭੇਜ ਦਿਉ ਠੀਕ ਹੈ ਜੀ ਧੰਨਵਾਦ